ਹੈਲੋ ਹਾਂਜੀ ਹਾਂਜੀ ਅੱਛਾ ਅੱਛਾ ਅੱਛਾ ਅੱਛਾ ਓਕੇ ਹਾਂਜੀ ਹਾਂਜੀ ਠੀਕ ਹੈ ਅੱਛਾ ਹੂੰ ਅੱਛਾ ਹਾਂਜੀ ਜਿਵੇਂ ਆਪਣੇ ਹੈਗੇ ਨੇ ਮਾਨਸਾ ਕਈ ਨੇਗੇ ਜਿਵੇਂ ਕਿ ਹੋ ਗਿਆ ਜੱਗੀ ਸਵੀਟਸ ਹੋ ਗਿਆ ਵਿੱਕੀ ਦਾ ਹੋ ਗਿਆ ਠੀਕ ਆ ਬਰਾੜ ਹੋ ਗਿਆ ਅਤੇ ਹੈ ਵੀ ਜ਼ਿਆਦਾ ਵਧੀਆ ਨੇ ਜਿਹੜੇ ਅੱਛੇ ਅੱਛੇ ਨੇ ਤਾਂ ਤੁਸੀਂ ਇਹਨਾਂ 'ਤੇ ਵਿਜਿਟ ਕਰ ਸਕਦੇ ਹੋ ਹਾਂ ਜਿਵੇਂ ਉੱਥੇ ਮੰਨ ਲਓ ਛੋਲੇ ਭਟੂਰੇ ਵਗੈਰਾ ਹੋ ਗਿਆ ਟਿੱਕੀ ਵਗੈਰਾ ਹੋ ਗਿਆ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਗਈਆਂ ਉਸ ਚੀਜ਼ਾਂ ਜ਼ਿਆਦਾ ਬੈਟਰ ਨੇ ਅਤੇ ਜਿਵੇਂ ਬਰਾੜ ਵਾਲਿਆਂ ਦੇ ਮਿਠਾਈ ਵਗੈਰਾ ਬਹੁਤ ਅੱਛੀਆਂ ਨੇਗੀਆਂ ਹਾਂ ਬਿਲਕੁਲ ਪੂਰਾ ਬਹੁਤ ਅੱਛੇ ਤਰੀਕੇ ਮੈਨੇਜ ਕੀਤਾ ਹੋਇਆ ਗਾ ਬਿਲਕੁਲ ਹਾਂ ਨਹੀਂ ਨਹੀਂ ਬਹੁਤ ਅੱਛਾ ਹੈਗਾ ਹਰ ਚੀਜ਼ ਦਾ ਧਿਆਨ ਰੱਖਿਆ ਜਾਂਦਾ ਗਾ ਜਿਵੇਂ ਬਹੁਤ ਅੱਛੇ ਤਰੀਕੇ ਉਹਨੂੰ ਖੁੱਲ੍ਹਾ ਗਾ ਬੈਠਣ ਦੀ ਸਿਟਿੰਗ ਅੱਛੀ ਕੀਤੀ ਹੋਈ ਆ ਬਾਕੀ ਸਫ਼ਾਈ ਦਾ ਪ੍ਰੋਪਰ ਧਿਆਨ ਦਿੱਤਾ ਜਾਂਦਾ ਵਾ ਕਿ ਹਰ ਚੀਜ਼ ਬਣ ਰਹੀ ਹੈ ਉਹਨੂੰ ਬਹੁਤ ਪ੍ਰੋਪਰ ਤਰੀਕੇ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਅਤੇ ਉਸ ਤਰ੍ਹਾਂ ਜਿਹੜੀਆਂ ਚੀਜ਼ਾਂ ਨੇ ਜਿਵੇਂ ਫਰੈੱਸ਼ ਹੀ ਯੂਜ ਕੀਤੀਆਂ ਜਾਂਦੀਆਂ ਨੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਅਗਰ ਤੁਸੀਂ ਵਿਜਿਟ ਕਰਦੇ ਹੋ ਤਾਂ ਬਿਲਕੁਲ ਹੂੰ ਤਾਂ ਅਗਰ ਮੇਰੀ ਜ਼ਰੂਰਤ ਪੈਂਦੀ ਹੈ ਤਾਂ ਵਾਪਿਸ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਬਾਤ ਨਹੀਂ ਅਗਰ ਹਾਂ ਹਾਂਜੀ ਹਾਂਜੀ ਹਾਂਜੀ ਠੀਕ ਠੀਕ ਹੈ ਜੀ ਓਕੇ ਜੀ ਓਕੇ ਬਾਏ